ਮੈਂ ਭੰਗੜਾ ਐਰੋਬਿਕਸ ਰੂਟੀਨ ਦੇ ਵੱਖ ਵੱਖ ਪਾਸਿਆਂ ਨੂੰ ਬਹੁਤ ਪਸੰਦ ਕਰਦਾ ਗਾ ਪਰ ਮੇਰੀ ਮਨਪਸੰਦ ਰੂਟੀਨ ਉਹ ਹੈ ਜਿਸ ਵਿੱਚ ਹਾਈ ਐਨਰਜੀ ਸਟੈਪਸ ਬੋਲੀਆਂ ਅਤੇ ਤਰਵੇਨ ਸਟੈਪਸ ਸ਼ਾਮਿਲ ਹੁੰਦੇ ਹਨ ਇਹ ਰੂਟੀਨ ਬਹੁਤ ਹੀ ਉਤਸ਼ਾਹਜਨਕ ਹੁੰਦੀਆਂ ਅਤੇ ਹਰ ਕੋਈ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਭਾਵਨਾ ਅਤੇ ਜੋਸ਼ ਨਾਲ ਭਰਪੂਰ ਹੁੰਦਾ ਹੈ ਇਸ ਭੰਗੜਾ ਐਰੋਬਿਕਸ ਰੂਟੀਨ ਨੂੰ ਖਾਸ ਬਣਾਉਣ ਵਾਲੀ ਚੀਜ਼ ਇਹ ਹੈ ਕਿ ਸਿਰਫ ਇੱਕ ਵਰਕਆਊਟ ਨਹੀਂ ਬਲਕਿ ਮੇਰੇ ਲਈ ਇੱਕ ਜਸ਼ਨ ਦਾ ਹਿੱਸਾ ਹੁੰਦਾ ਹੈ ਸੰਗੀਤ ਦਾ ਤੇਜ਼ ਤਾਲ ਕੋਰਸ ਦੀ ਸਾਧਨਾ ਅਤੇ ਮਜ਼ੇਦਾਰ ਚਾਲਨਾ ਇਸ ਨੂੰ ਬਹੁਤ ਹੀ ਖਾਸ ਬਣਾਉਂਦੀਆਂ ਹਨ ਇਹ ਮੈਨੂੰ ਸਰੀਰਕ ਤੌਰ 'ਤੇ ਤੰਦਰੁਸਤ ਅਤੇ ਮਨੋਰੰਜਨ ਮਨੋਰੰਜਨ ਬਣਾਉਂਦਾ ਹੈ ਜੋ ਕਿ ਮੇਰੇ ਲਈ ਬਹੁਤ ਮਹੱਤਵਪੂਰਨ ਹੈ ਇਹ ਰੂਟੀਨ ਮੈਨੂੰ ਮੇਰੇ ਭਰਵਾਨ ਬੋਲੀਬੁੱਡ ਗੀਤਾਂ ਵਿੱਚ ਜੋੜਦਾ ਏ ਅਤੇ ਇਹ ਮੇਰੇ ਮੈਨੂੰ ਮੇਰੇ ਦਿਨ ਦੀ ਚੇਤਾਵਨਾ ਤੋਂ ਛੁੱਟੀ ਦਿੰਦਾ ਹੈ ਇਹ ਮੈਨੂੰ ਸਰੀਰਕ ਤੰਦਰੁਸਤੀ ਨੂੰ ਸੌਖੀ ਅਤੇ ਮਜ਼ੇਦਾਰ ਤਰੀਕੇ ਨਾਲ ਬਰਕਰਾਰ ਰੱਖਣ ਵਿੱਚ ਮਦਦ ਕਰਦਾ ਹੈ ਮੈਂ ਇੱਕ ਮਨਪਸੰਦ ਭੰਗੜਾ ਐਰੋਬਿਕਸ ਰੂਟੀਨ ਬਾਰੇ ਦੱਸ ਸਕਦਾ ਹਾਂ ਜੋ ਕਿ ਮੇਰੇ ਲਈ ਖਾਸ ਹੈ ਇਸ ਰੂਟੀਨ ਵਿੱਚ ਸਾਰਾ ਸਮੂਹ ਇੱਕ ਉਤਸ਼ਾਹ ਭਰੀ ਮੁਕਾਬਲੇ ਵਾਲੀ ਸੰਗੀਤ ਰਾਹੀ ਭੰਗੜੇ ਦੀ ਪਰੰਪਰਾ ਪਾਸਿਆਂ ਨੂੰ ਮਾਡਰਨ ਐਰੋਬਿਕਸ ਨਾਲ ਜੋੜਦਾ ਹੈ ਇਸ ਨੂੰ ਰੂਟੀਨ ਨੂੰ ਪੂਰਾ ਕਰਨ ਵਿੱਚ ਬਹੁਤ ਮਜ਼ੇਦਾਰ ਲੱਗਦਾ ਹੈ ਧੰਨਵਾਦ